ਹੈਲੋ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਪੂਰਥਲੇ ਤੋਂ ਬੋਲ ਰਹੇ ਹੋ ਭਾਜੀ ਜਿਮ 'ਚੋਂ ਬੋਲ ਰਹੇ ਪਰੋ ਅਲਟੀਮੇਟ ਟਰੇਨਰ ਓਕੇ ਓਕੇ ਓਕੇ ਭਾਜੀ ਮੈਂ ਨਾ ਜਿਮ 'ਚ ਇਧਰ ਕਪੂਰਥਲੇ ਨਵਾਂ ਆਇਆਂ ਹਲੇ ਅਤੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਕਿ ਇੱਧਰ ਜਿਮ ਵਧੀਆ ਇੱਕ ਮਤਲਬ ਇੱਧਰ ਤੁਹਾਡੇ ਪ੍ਰੋ ਅਲਟੀਮੇਟ ਵਧੀਆ ਜਿੰਮ ਅ ਤਾਂ ਮੈਂ ਇੱਕ ਵਾਰ ਵੀ ਵਿਜਿਟ ਵੀ ਕਰਕੇ ਗਿਆ ਸੀ ਪਰਸੋਂ ਤਾਂ ਤੁਸੀਂ ਮੈਨੂੰ ਮਿਲੇ ਨਹੀਂ ਅਤੇ ਮੈਨੂੰ ਨਾ ਭਾਜੀ ਨੇ ਤੁਹਾਡਾ ਨੰਬਰ ਦਿੱਤਾ ਉੱਥੇ ਕਿਸੇ ਨੇ ਕਿ ਤੁਸੀਂ ਬਾਈ ਨਾਲ ਗੱਲ ਕਰ ਲਓ ਕਿ ਟਰੇਨਰ ਨੇ ਅਤੇ ਤੁਹਾਨੂੰ ਦੱਸ ਦੇਣਗੇ ਸਾਰਾ ਕੁਛ ਅਤੇ ਭਾਜੀ ਮੈਂ ਇਹ ਕਨਫਰਮ ਕਰਨਾ ਸੀ ਕਿ ਜਿਵੇਂ ਮੈਂ ਆਪਣਾ ਵੇਟ ਲੂਜ ਕਰਨਾ ਹੈ ਵੇਟ ਲੂਜ ਕਰਨ 'ਚ ਹੈਲਪ ਚਾਹੀਦੀ ਮੈਨੂੰ ਤਾਂ ਕਿੰਨੀ ਫੀਸ ਸਾਲ ਦੀ ਆ ਕੀ ਪਲੈਨ ਆ ਕੀ ਮਤਲਬ ਮੈਨੂੰ ਐਕਸਾਈਜ ਕਰਨੀਆਂ ਚਾਹੀਦੀਆਂ ਨੇ ਘਰ ਹੋਮ ਵਰਕਆਊਟ ਜਾਂ ਕੀ ਉੱਥੇ ਆ ਕੇ ਮੈਂ ਕਰਾਂ ਅਤੇ ਤੁਸੀਂ ਮੈਨੂੰ ਸਾਰਾ ਕੁਝ ਦੱਸ ਸਕਦੇ ਹੋ ਓਕੇ

ਮੇਰਾ ਵੇਟ ਹੈਗਾ ਭਾਜੀ ਇੱਕ ਕੁਇੰਟਲ ਵੀਹ ਕਿਲੋ ਭਾਜੀ ਬਸ ਥੋੜ੍ਹਾ ਜਿਹਾ ਜੀ ਓਵਰ ਹੋ ਗਿਆ ਖਾ ਖਾ ਕੇ ਚਲੋ ਕੋਈ ਨਹੀਂ ਚੱਲਦਾ ਜੀ ਉਹ ਥੋੜ੍ਹਾ ਜਿਹਾ ਨਾ ਭਾਜੀ ਡ੍ਰਿੰਕਿੰਗ ਨਾ ਥੋੜ੍ਹੀ ਜਿਹੀ ਮੇਰੀ ਆਦਤ ਗਲਤ ਸੀ ਗੀ ਜਦੋਂ ਮੈਂ ਕਰਨ ਲੱਗਦਾ ਸੀ ਨਾ ਡਰਿੰਕ ਤਾਂ ਫਿਰ ਡਰਿੰਕ ਕਰੀ ਜਾਂਦਾ ਸੀ ਕਰੀ ਜਾਂਦਾ ਸੀ ਹਾਂਜੀ ਹਾਂਜੀ ਭਾਜੀ ਭਾਜੀ ਡਰਿੰਕ ਤਾਂ ਪੀ ਸਕਦਾਂ ਭਾਜੀ ਦੇਖੋ ਮੈਂ ਖਾਊਂਗਾ ਨਹੀਂ ਪੀ ਤਾਂ ਸਕਦਾਂ ਹਾਏ ਓ ਭਾਜੀ ਹਾਏ ਐਂ ਨਾ ਕਹੋ ਭਾਜੀ ਹਾਏ ਐਂ ਕਾਹਨੂੰ ਕਹਿੰਦੇ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਜੀ ਓਟਸ ਸਰ ਓਟਸ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਜੀ ਓਕੇ ਅੱਛਾ ਜੀ ਇੱਕ ਮਿੰਟ ਇੱਕ ਮਿੰਟ ਭਾਜੀ ਹਾਂਜੀ ਭਾਜੀ ਹੁਣ ਦੱਸੋ ਜੀ ਠੀਕ ਹੈ ਜੀ

ਓਕੇ ਭਾਜੀ

ਭਾਜੀ ਉਂਝ ਮੈਂ ਨੋਨ ਵੈਜ ਖਾ ਲੈਦਾ ਏਂ ਜਿਵੇਂ ਬੋਇਲਡ ਤਾਂ ਫਿਰ ਬੋਇਲਡ ਚਿਕਨ ਵੀ ਖਾ ਸਕਦਾ ਜਾਂ ਫਿਰ ਬੋਇਲਡ ਐੱਗ ਹੋ ਗਏ ਠੀਕ ਆ ਠੀਕ ਆ ਭਾਜੀ ਕੋਈ ਨਹੀਂ ਭਾਜੀ ਫਿਰ ਮੈਂ ਮਾਰੂੰਗਾ ਗੇੜਾ ਹੁਣ ਠੀਕ ਆ ਜਲਦੀ ਹੈ ਤੁਹਾਡੇ ਕੋਲ ਹਾਂ ਚਲੋ ਓਕੇ ਭਾਜੀ ਥੈਂਕ ਯੂ ਜੀ